ਤਿਉਹਾਰ 'ਤੇ ਕਈ ਮੈਂ ਮੂਰਤੀਆਂ ਬਣਾਈਆਂ ਹਨ ਜਿਵੇਂ ਕ੍ਰਿਸ਼ਨ ਜਨਮਅਸ਼ਟਮੀ ਤੇ ਮੂਰਤੀ ਬਣਾਈ ਸੀ ਉਹ ਬਹੁਤ ਸਾਰੀ ਬਹੁਤ ਸਾਰਿਆਂ ਨੇ ਬੜੀ ਪਸੰਦ ਕੀਤੀ ਕਿਉਂਕਿ ਉਹ ਕਹਿੰਦੇ ਤੁਸੀਂ ਬਹੁਤ ਸੋਹਣੀਆਂ ਮੂਰਤੀਆਂ ਬਣਾਉਂਦੇ ਹੋ ਇਸ ਲਈ ਮਨ ਨੂੰ ਬੜੀ ਖੁਸ਼ੀ ਮਿਲੀ ਕਿ ਮੈਂ ਬਹੁਤ ਵਧੀਆ ਮੂਰਤੀ ਬਣਾਉਂਦਾ ਜਿਵੇਂ ਸ਼ਿਵ ਜੀ ਦੀ ਮੂਰਤੀ ਸ਼ਿਵਰਾਤਰੀ 'ਤੇ ਬਣਾਈ ਗਈ ਉਹ ਵੀ ਬੜੇ ਜਣਿਆਂ ਨੇ ਪਸੰਦ ਕੀਤੀ ਤਾਂ ਬੜਾ ਬੜਾ ਮਨ ਖੁਸ਼ ਹੋਇਆ ਉਹ ਤੋਂ ਬਾਅਦ ਹਨੂੰਮਾਨ ਜੀ ਦੀ ਮੈਂ ਮੂਰਤੀ ਤਿਆਰ ਕੀਤੀ ਉਹ ਵੀ ਕਾਫੀ ਬੰਦਿਆਂ ਨੇ ਪਸੰਦ ਕੀਤੀ ਇਹ ਤੋਂ ਬਾਅਦ ਦੁਰਗਾ ਮਾਤਾ ਦੀ ਮੁੰਦਰੀ ਮੂਰਤੀ ਬਣਾਈ ਗਈ ਉਹ ਤੋਂ ਬਾਅਦ ਵਿੱਚ ਮੈਂ ਸ਼ੇਰਾਂ ਵਾਲੀ ਮਾਤਾ ਦੀ ਮੂਰਤੀ ਬਣਾਈ ਇਸ ਲਈ ਮੇਰੇ ਮਨ ਨੂੰ ਬੜੀ ਖੁਸ਼ੀ ਅਤੇ ਬੜਾ ਵਧੀਆ ਲੱਗਾ ਹਾਂ ਮੈਂ ਕਈ ਮੇਰੇ ਮਨ ਵਿੱਚ ਨਿੱਕੇ ਹੁੰਦਿਆਂ ਤੋਂ ਸ਼ੌਂਕ ਵੀ ਕਿ ਮੈਨੂੰ ਮੂਰਤੀਆਂ ਬਣਾਉਣ ਦਾ ਬਹੁਤ ਸ਼ੌਂਕ ਸੀ ਇਸ ਲਈ ਮੈਂ ਕਈ ਵਾਰ ਦਿਵਾਲੀ ਵਾਲੇ ਦਿਨ ਤਿਉਹਾਰ 'ਤੇ ਦਿਵਾਲੀ ਘਰ ਬਣਾਇਆ ਗਿਆ ਜਿਸ ਲਈ ਉਹ ਲਛਮੀ ਮਾਤਾ ਦੀ ਉਹਦੇ ਉੱਤੇ ਤਿਉਹਾਰ 'ਤੇ ਪੂਜਾ ਕੀਤੀ ਅਤੇ ਉਹਦੀ ਮੂਰਤੀ ਬਣਾ ਕੇ ਉਹਦੀ ਪੂਜਾ ਕੀਤੀ ਗਈ ਇਸ ਲਈ ਮੇਰੇ ਮਨ ਵਿੱਚ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਨੂੰ ਮੂਰਤੀਆਂ ਬਣਾਉਣੀਆਂ ਚਾਹੀਦੀਆਂ ਹਨ